ਆਮ ਤੌਰ 'ਤੇ ਅਸੀਂ ਘਰ ਵਿੱਚ ਦੁਪਹਿਰ ਅਤੇ ਰਾਤ ਦੇ ਖਾਣੇ ਵਿੱਚ ਰੋਟੀ ਸਬਜ਼ੀ ਹੀ ਪਕਾਉਂਦੇ ਹਾਂ ਕਿਉਂਕਿ ਪੇਂਡੂ ਜੀਵਨ ਵਿੱਚ ਰੋਟੀ ਸਬਜ਼ੀ ਇੱਕ ਖ਼ਾਸ ਭੋਜਨ ਦੀ ਮਹੱਤਤਾ ਰੱਖਦਾ ਹੈ ਇਸ ਤੋਂ ਇਲਾਵਾ ਘਰ ਵਿੱਚ ਕਿਸੇ ਵੀ ਪ੍ਰਕਾਰ ਦੇ ਪੈਕ ਕੀਤੇ ਹੋਏ ਭੋਜਨ ਦੀ ਵਰਤੋਂ ਨਹੀਂ ਕੀਤੀ ਜਾਂਦੀ